ਸਤਿ ਸ਼੍ਰੀ ਅਕਾਲ ਕੁਝ ਪੌਦੇ ਕੁਦਰਤੀ ਤੌਰ 'ਤੇ ਨਾਜ਼ੁਕ ਹੁੰਦੇ ਹਨ ਅਤੇ ਉਹਨਾਂ ਦੀ ਜਿਹੜੀ ਸੰਭਾਲ ਹੁੰਦੀ ਹੈ ਉਹ ਬਹੁਤ ਮੁਸ਼ਕਿਲ ਹੁੰਦੀ ਹੈ ਖਾਸ ਕਰਕੇ ਕਠੋਰ ਗਰਮੀਆਂ ਜਾਂ ਸਰਦੀ ਵਿੱਚ ਇਹਨਾਂ ਦੇ ਵਿੱਚ ਸੰਭਾਲ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ ਇਹਨਾਂ ਨੂੰ ਸੰਭਾਲਣ ਦੇ ਕੁਝ ਤਰੀਕੇ ਹਨ ਜੋ ਕਿ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜੇ ਮੁਸ਼ਕਿਲ ਪੌਦਿਆਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਆਉਂਦੇ ਹਨ ਆਰਚੀਟਸ ਇਹ ਨਾਜ਼ੁਕ ਹੁੰਦੇ ਹਨ ਅਤੇ ਇਹਨਾਂ ਦੀ ਦੇਖਭਾਲ ਵੀ ਬਹੁਤ ਕਰਨੀ ਪੈਂਦੀ ਹੈ ਦੂਜੇ ਹੁੰਦੇ ਬੋਨਸਾਈ ਇਹਨਾਂ ਦੀ ਵੀ ਦੇਖਭਾਲ ਬਹੁਤ ਜ਼ਰੂਰੀ ਹੁੰਦੀ ਹੈ ਤੀਜੇ ਹੁੰਦੇ ਨੇ ਗਾਡਨੀਆਂ ਇਹ ਵੀ ਬਹੁਤ ਨਾਜ਼ੁਕ ਹੁੰਦੇ ਹਨ ਗਰਮੀਆਂ ਵਿੱਚ ਇਹਨਾਂ ਦੀ ਦੇਖਭਾਲ ਬਹੁਤ ਕਰਨੀ ਪੈਂਦੀ ਹੈ ਅਤੇ ਚੌਥੇ ਹੁੰਦੇ ਆ ਫਰਨਸ ਇਹ ਬਹੁਤ ਨਾਜ਼ੁਕ ਹੁੰਦੇ ਹਨ ਕਠੋਰ ਗਰਮੀਆਂ ਵਿੱਚ ਪੌਦਿਆਂ ਨੂੰ ਦੇਖਭਾਲ ਕਰਨ ਲਈ ਸਾਨੂੰ ਉਹਨਾਂ ਨੂੰ ਪਾਣੀ ਦੇਣਾ ਚਾਹੀਦਾ ਹੈ ਪਾਣੀ ਦੇਣ ਵਿੱਚ ਕੀ ਹੁੰਦਾ ਕੰਟਰੋਲ ਪਾਣੀ ਦੇਣਾ ਚਾਹੀਦਾ ਜਿਵੇਂ ਸਵੇਰੇ ਜਾਂ ਸ਼ਾਮ ਨੂੰ ਪਾਣੀ ਦੋਵੇਂ ਜਦੋਂ ਤਾਪਮਾਨ ਘੱਟ ਹੁੰਦਾ ਨਾ ਉਦੋਂ ਪਾਣੀ ਘੱਟ ਦੇਣਾ ਚਾਹੀਦਾ ਅਤੇ ਮਿੱਟੀ ਵਿੱਚ ਨਾ ਸਾਨੂੰ ਨਾ ਮਲਚ ਦੀ ਪਰਤ ਪਾਉਣੀ ਚਾਹੀਦੀ ਜਿਹਦੇ ਵਿੱਚ ਨਾ ਮਿੱਟੀ ਦੇ ਉੱਤੇ ਨਾ ਨਮੀ ਬਰਕਰਾਰ ਰਹਿੰਦੀ ਆ ਸਾਨੂੰ ਬੂਟਿਆਂ ਨੂੰ ਨਾ ਛਾਂ ਪਰਾ ਪ੍ਰਦਾਨ ਕਰਨੀ ਚਾਹੀਦੀ ਹੈ ਛਾਂ ਵਾਲੇ ਖੇਤਰਾਂ ਵਿੱਚ ਪੌਦਿਆਂ ਨੂੰ ਲਾਉਣਾ ਚਾਹੀਦਾ ਹਵਾ ਵਿੱਚ ਨਮੀ ਜਿੱਦਾ ਬਣਾਉਣ ਲਈ ਨਾ ਸਾਨੂੰ ਪਾਣੀ ਛਿੜਕਣਾ ਚਾਹੀਦਾ ਪੌਦਿਆਂ ਨੂੰ ਪਾਣੀ ਛਿੜਕਣ ਨਾਲ ਉਹਨਾਂ ਦੀ ਨਮੀ ਵੱਧ ਜਾਂਦੀ ਹੈ ਕਠੋਰ ਸਰਦੀਆਂ ਵਿੱਚ ਜਿੱਦਾਂ ਪੌਦਿਆਂ ਨੂੰ ਦੇਖਭਾਲ ਕਰਨੀ ਉਸ ਲਈ ਆਪਾਂ ਕੀ ਕਰ ਸਕਦੇ ਹਾਂ ਤਾਪਮਾਨ ਦੇ ਬਾਰੇ ਸਾਨੂੰ ਸਾਵਧਾਨੀ ਹੋਣੀ ਚਾਹੀਦੀ ਹੈ ਜਿਵੇਂ ਕਿ ਬੂਟਿਆਂ ਨੂੰ ਘਰ ਦੇ ਅੰਦਰ ਰੱਖਣਾ ਚਾਹੀਦਾ ਜਿਹੜੇ ਸੰਵੇਦਨਸ਼ੀਲ ਪੌਦੇ ਹੁੰਦੇ ਉਹਨਾਂ ਨੂੰ ਘਰ ਦੇ ਅੰਦਰ ਗਰਮ ਮਾਹੌਲ ਵਿੱਚ ਰੱਖਣਾ ਚਾਹੀਦਾ ਉਹਨਾਂ ਦੇ ਲਾਗੇ ਹੀਟ ਲੈਂਪ ਲਾਉਣਾ ਚਾਹੀਦਾ ਮਿੱਟੀ ਦੀ ਸੁਰਕਸ਼ਾ ਕਰਨ ਲਈ ਆਪਾਂ ਮਲਚ ਦੀ ਵਰਤੋਂ ਕਰ ਸਕਦੇ ਹਾਂ ਜਿਹੜੀਆਂ ਜੜ੍ਹਾਂ ਨੂੰ ਠੰਢ ਤੋਂ ਬਚਾਉਂਦੀ ਆ ਬੂਟਿਆਂ ਦਾ ਆਪਾਂ ਇਨਸੂਲੇਸ਼ਨ ਕਰਨੀ ਚਾਹੀਦੀ ਹੈ ਸਾਨੂੰ ਠੰਢਾ ਤੋਂ ਬਚਾਉਣ ਲਈ ਉਸਦੇ ਆਲੇ ਦੁਆਲੇ ਕੱਪੜਾ ਰੱਖਣਾ ਚਾਹੀਦਾ ਉਹਨਾਂ ਨੂੰ ਪਾਣੀ ਦੇਣਾ ਜਿਹੜਾ ਹੁੰਦਾ ਨਾ ਕੰਟਰੋਲ ਪਾਣੀ ਦਾ ਥੋੜ੍ਹਾ ਹੀ ਪਾਣੀ ਦੇਣਾ ਚਾਹੀਦਾ ਇਹਨਾਂ ਨੂੰ ਪਾਣੀ ਵਿੱਚ ਬਸ ਇੰਨਾ ਯਕੀਨ ਬਣਾਉਣਾ ਚਾਹੀਦਾ ਕਿ ਮਿੱਟੀ ਸੁੱਕੀ ਨਾ ਰਹੇ ਹਾਂਜੀ ਮਾਰ ਪਾਣੀ ਦੇਣਾ ਚਾਹੀਦਾ ਸਾਨੂੰ ਸਵੇਰੇ ਪਾਣੀ ਦੇਣਾ ਜੜ੍ਹਾਂ ਦੇ ਵਿੱਚ ਪਾਣੀ ਪਹੁੰਚਾਉਣ ਦਾ ਸਮਾਂ ਮਿਲਣਾ ਚਾਹੀਦਾ ਜਿਹੜੀ ਸਮਾਰਟ ਟਕਨੀਕਾਂ ਹੁੰਦੀਆਂ ਉਹਨਾਂ ਦੀ ਗੱਲ ਕਰੀਏ ਤਾਂ ਇਹ 'ਚ ਕੀ ਹੁੰਦੀ ਆ ਮਲਚ ਸੈਂਸਰ ਜਿਹੜੇ ਹੁੰਦੇ ਨਾ ਮੋਇਸਚਰ ਸੈਂਸਰ ਜਿਹੜੇ ਹੁੰਦੇ ਆ ਉਹ ਲਗਾਉਣੇ ਚਾਹੀਦੇ ਜਿਹਦੇ ਨਾਲ ਕਿ ਸਾਨੂੰ ਪਤਾ ਚੱਲ ਜਾਂਦਾ ਕਿ ਪਾਣੀ ਦੀ ਮਾਤਰਾ ਕਿੰਨੀ ਹੈ ਉਹਦੇ ਵਿੱਚ ਇਹਨਾਂ ਤਰੀਕੇ ਦੇ ਸਾਵਧਾਨੀਆਂ ਨਾਲ ਨਾਜ਼ੁਕ ਪੌਦਿਆਂ ਨੂੰ ਕਠੋਰ ਗਰਮੀਆਂ ਅਤੇ ਸਰਦੀਆਂ ਵਿੱਚ ਜਿੰਦਾ ਰੱਖਣ ਵਿੱਚ ਮਦਦ ਕਰ ਸਕਦੀਆਂ ਹਨ ਧੰਨਵਾਦ